ਜਾਨਵਰਾਂ ਦੇ ਡੰਗਾਂ ਤੋਂ ਸੁਰੱਖਿਅਤ ਰਹਿਣ ਲਈ ਜਿਵੇਂ ਕਿ ਸੱਪ ਦੇ ਡੰਗਣ ਨਾਲ ਫੁੱਲ ਸਾਈਜ਼ ਦੇ ਬੂਟ ਪਾਉਣੇ ਚਾਹੀਦੇ ਹਨ ਚੱਪਲ ਵਗੈਰਾ ਨਹੀਂ ਪਾਉਣੀ ਚਾਹੀਦੀ ਅਤੇ ਕੀੜੇ ਦੇ ਡੰਗ ਮਾਰਨ ਤੋਂ ਫੁੱਲ ਜੁਰਾਬ ਪਹਿਨਣੀ ਚਾਹੀਦੀ ਹੈ